ਕੁਕਿੰਗ ਵਿੱਚ ਇੰਟਰਸਟ ਤਾਂ ਮੇਰਾ ਸ਼ੁਰੂ ਤੋਂ ਹੀ ਸੀ ਮੈਂ ਅੱਜ ਤੱਕ ਬਹੁਤ ਵੱਖ ਵੱਖ ਪਕਵਾਨਾਂ ਨੂੰ ਪਕਾਉਣ ਪਕਾਇਆ ਹੈ ਅਤੇ ਉਹਨਾਂ ਦਾ ਅਨੁਭਵ ਬਹੁਤ ਹੀ ਵੱਖਰਾ ਹੈ ਹਰ ਇੱਕ ਵਿਅੰਜਨ ਨੂੰ ਪਕਾਉਣ ਦਾ ਆਪਣਾ ਹੀ ਮਜ਼ਾ ਹੈ ਜਿਵੇਂ ਕਿ ਮੈਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਹਨ ਜਿਵੇਂ ਕਿ ਸਬਜ਼ੀਆਂ ਵਿੱਚ ਪਨੀਰ ਭਿੰਡੀ ਬੈਂਗਣ ਸ਼ਿਮਲਾ ਮਿਰਚ ਅਤੇ ਦਾਲਾਂ ਵਿੱਚ ਰਾਜਮਾਂਹ ਦਾਲ ਕੜ੍ਹੀ ਅਤੇ ਹੋਰ ਵੀ ਬਹੁਤ ਸਾਰੇ ਇਹਨਾਂ ਸਭ ਦਾ ਅਨੁਭਵ ਮੇਰੇ ਲਈ ਅਲੱਗ ਸੀ ਅਤੇ ਮੈਨੂੰ ਹਰ ਇੱਕ ਚੀਜ਼ ਬਣਾਉਣ ਦਾ ਅਲੱਗ ਹੀ ਮਜ਼ਾ ਆਉਂਦਾ ਹੈ ਅਤੇ ਮੈਨੂੰ ਅਤੇ ਮੈਂ ਮਿਠਾਈ ਵਿੱਚ ਵੀ ਬਹੁਤ ਕੁਝ ਬਣਾਇਆ ਹੈ ਇੱਕ ਵਾਰ ਮੈਂ ਗੁਲਾਬ ਜਾਮੁਨ ਜਲੇਬੀਆਂ ਅਤੇ ਹੋਰ ਵੀ ਬਹੁਤ ਕੁਝ ਬਣਾਇਆ ਹੈ ਅਤੇ ਸਨੈਕ ਵਿੱਚ ਮੈਂ ਸੈਂਡਵਿਚ ਪੀਜ਼ਾ ਬਰਗਰ ਨਿਊਡਲ ਅਤੇ ਮੈਗੀ ਵੀ ਬਣਾ ਲੈਂਦੀ ਹਾਂ ਮੈਨੂੰ ਇਹਨਾਂ ਵਿੱਚ ਸਭ ਤੋਂ ਸੌਖਾ ਕੰਮ ਸਬਜ਼ੀਆਂ ਵਿੱਚੋਂ ਮੈਨੂੰ ਸਭ ਤੋਂ ਸੌਖਾ ਕੰਮ ਲੱਗਦਾ ਹੈ ਪਨੀਰ ਬਣਾਉਣਾ ਪਨੀਰ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਇਸ ਨੂੰ ਬਣਾਉਣ ਲਈ ਕੁਝ ਜ਼ਿਆਦਾ ਵਕਤ ਨਹੀਂ ਲੱਗਦਾ ਜਿਵੇਂ ਕਿ ਪਨੀਰ ਵਿੱਚ ਆਮ ਪਿਆਜ਼ ਟਮਾਟਰ ਪੈਂਦੇ ਹਨ ਅਤੇ ਹੋਰ ਸਪਾਈਸਿਸ ਪੈਂਦੀਆਂ ਹਨ ਅਤੇ ਰਾਜਮਾਂਹ ਬਣਾਉਣਾ ਵੀ ਮੈਨੂੰ ਆਸਾਨ ਲੱਗਦਾ ਹੈ ਅਤੇ ਹੋਰ ਰਾਜਮਾਂਹ ਨੂੰ ਉਬਾਲਣਾ ਥੋੜ੍ਹਾ ਟਾਈਮ ਹੈ ਬਾਕੀ ਇਸਨੂੰ ਬਣਾਉਣਾ ਬਹੁਤ ਹੀ ਆਸਾਨ ਕੰਮ ਹੈ ਅਤੇ ਸਭ ਤੋਂ ਪਹਿਲਾਂ ਜਦੋਂ ਮੈਂ ਕੁਕਿੰਗ ਕੀਤੀ ਸੀ ਤਾਂ ਮੈਂ ਰਾਜਮਾਂਹ ਹੀ ਬਣਾਏ ਸਨ ਉਸ ਤੋਂ ਬਾਅਦ ਮੈਨੂੰ ਸਨੈਕਸ ਵਿੱਚ ਪੀਜ਼ਾ ਬਣਾਉਣਾ ਬਹੁਤ ਹੀ ਮਜ਼ਾ ਮਜੇਦਾਰ ਲੱਗਦਾ ਹੈ ਅਤੇ ਮੈਨੂੰ ਇਹ ਖਾਣਾ ਵੀ ਬਹੁਤ ਪਸੰਦ ਹੈ ਧੰਨਵਾਦ